ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਭਾਰਤ ਦੇ ਇਤਿਹਾਸ ਦੇ ਬਾਰੇ ਦੱਸਦੀ ਹਾਂ ਭਾਰਤ ਦਾ ਇਤਿਹਾਸ ਅਤਿਅਮ ਸਮ੍ਰਿਧ ਵਿਵਿਧ ਰਿਹਾ ਹੈ ਪਹਿਲਾਂ ਤੋਂ ਹੀ ਪਹਿਲਾਂ ਰਾਜਾ ਮਹਾਰਾਜਾ ਦਾ ਸਮੇਂ ਹੁੰਦਾ ਸੀਗਾ ਵੈਦਿਕ ਕਾਲ ਚੱਲਿਆ ਫਿਰ ਮੋਰਿਆ ਔਰ ਗੁਪਤਾ ਦਾ ਸਮਰਾਜ ਆਇਆ ਉਹ ਦੇ ਬਾਅਦ ਮੁਗਲ ਦਾ ਸਮਰਾਜ ਆਇਆ ਮੁਗਲ ਸਮਰਾਜ 'ਚ ਅਕਬਰ ਅਕਬਰ ਤੋਂ ਬਾਅਦ ਉਨ੍ਹਾਂ ਦਾ ਬੇਟਾ ਫਿਰ ਉਹਨਾਂ ਦੇ ਬੇਟੇ ਕਿੰਨੇ ਰਾਜਾ ਆਏ ਉਹਦੇ ਬਾਅਦ ਬ੍ਰਿਟਿਸ਼ ਸ਼ਾਸਨ ਦਾ ਕਾਲ ਆਇਆ ਬ੍ਰਿਟਿਸ਼ ਸ਼ਾਸਨ ਦੇ ਕਾਲ ਨੇ ਭਾਰਤ ਜੋ ਸਾਡੀ ਸੋਨੇ ਦੀ ਚਿੜੀ ਕਹਿਲਾਇਆ ਜਾਂਦਾ ਸੀ ਪੂਰੀ ਤਰੀਕੇ ਨਾਲ ਇਹਨਾਂ ਨੂੰ ਸਾਨੂੰ ਗਰੀਬ ਕਰ ਤਾ ਸੀ ਸਿੰਗੂੜਤਾ ਸੀ ਜਿਨ੍ਹਾਂ ਤੋਂ ਲੜਨ ਲਈ ਕਿੰਨੇ ਸਾਰੇ ਦੇਸ਼ ਦੇ ਰ ਵਧੀਆ ਬੰਦੇ ਕਿੰਨੇ ਸਾਰੇ ਫਰੀਡਮ ਫਾਈਟਰਸ ਅੱਗੇ ਆ ਗਏ ਸੀ ਉੱਨੀ ਸੌ ਸੰਤਾਲੀ ਵਿੱਚ ਆਖਿਰ ਜਾ ਕੇ ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਆਪਾਂ ਇਹ ਇਤਿਹਾਸ ਰਚਿਆ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਵਿੱਚ ਜਦੋਂ ਦੇਸ਼ ਆਜ਼ਾਦ ਹੋ ਗਿਆ ਬ੍ਰਿਟਿਸ਼ ਦੇ ਸਾਰੇ ਲੋਕ ਅੰਗਰੇਜ਼ ਸਾਰੇ ਭਾਰਤ ਨੂੰ ਛੱਡ ਕੇ ਚਲੇ ਗਏ ਜਦੋਂ ਭਾਰਤ ਆਜ਼ਾਦ ਹੋਇਆ ਉਹ ਤੋਂ ਬਾਅਦ ਭਾਰਤ ਨੇ ਆਪਣੀ ਸੰਸਕ੍ਰਿਤੀ ਅਰਥ ਵਿਵਸਥਾ ਔਰ ਕਿੰਨੀ ਵੀ ਜੋ ਭਾਰਤ ਦੀ ਜੋ ਇੱਕ ਪਹਿਚਾਨ ਸੀ ਜੋ ਖੋਹ ਦਿੱਤੀ ਸੀ ਉਹਨੂੰ ਵਿਕਾਸ ਕੀਤੀ ਕਈ ਸਾਰੇ ਧਰੋਹਰ ਅਤੇ ਕਿੰਨੀ ਸਾਰੀ ਸੰਸਕ੍ਰਿਤੀ ਅੱਜ ਇਹ ਭਾਰਤ ਦੀ ਕਲਾ ਉਹਨੂੰ ਨੂੰ ਹੋਰ ਵੀ ਜ਼ਿਆਦਾ ਵਿਭਾਜਿਤ ਕਰਦੀ ਸੀ ਉਹਨਾਂ ਨੂੰ ਵਾਪਿਸ ਤੋਂ ਸਿੰਗੋੜਿਆ ਵਾਪਿਸ ਲੋਕਾਂ ਨੂੰ ਉਹਨਾਂ ਨੂੰ ਉੱਨਤੀ ਦੇ ਰਾਹ 'ਤੇ ਲੈ ਕੇ ਜਾਣ ਲਈ ਕਿਹਾ ਅਤੇ ਉਹ ਤੋਂ ਬਾਅਦ ਇੱਕ ਸਮਰਿਧ ਅਤੇ ਇੱਕ ਲੋਕਤੰਤਰ ਦੇਸ਼ ਬਣਾਇਆ ਜਿਹਦੇ 'ਚ ਲੋਕ ਸਾਰੇ ਧਰਮ ਦੇ ਇਕਦਮ ਹੋਵੇ ਕੁਲ ਮਿਲਾ ਕੇ ਜੇ ਅਸੀਂ ਕਹੀਏ ਕਿ ਭਾਰਤ ਨੇ ਆਪਣੇ ਇਤਿਹਾਸ ਵਿੱਚ ਆਪਣੇ ਆਪ ਨੂੰ ਇੱਦਾਂ ਸੰਜੋਇਆ ਹੈ ਅਤੇ ਅੱਜ ਵੀ ਉਹ ਬੜਾ ਸਿਮ੍ਰਿਧ ਅਤੇ ਵਿਕਾਸਸ਼ੀਲ ਹੈ ਮੇਰੇ ਲਈ ਕਈ ਸਾਰੇ ਇਤਿਹਾਸ ਦੇ ਪਲ ਬਹੁਤ ਹੀ ਜ਼ਿਆਦਾ ਮਾਣ ਵਾਲੇ ਰਹੇ ਆ ਉਹਨਾਂ ਵਿੱਚ ਮੈਂ ਇੱਕ ਕਹਾਂਗੀ ਜਦੋਂ ਜਲ੍ਹਿਆਂਵਾਲਾ ਬਾਗ ਹੋਇਆ ਸੀ ਜਦੋਂ ਲੋਰਡ ਡਲਹੌਜ਼ੀ ਨੇ ਲੋਕਾਂ 'ਤੇ ਬੰਦੂਕਾਂ ਅਰ ਗੋਲੀਆਂ ਚਲਾਤੀਆ ਅਤੇ ਕਿੰਨੇ ਲੋਕ ਮਰ ਗਏ ਸੀ ਉਹਤੋਂ ਬਾਅਦ ਭਗਤ ਸਿੰਘ ਜੀ ਬਹੁਤ ਛੋਟੇ ਹੁੰਦੇ ਸੀ ਉਹਨਾਂ ਨੇ ਸੋਚਿਆ ਸੀ ਕਿ ਮੈਂ ਵੱਡੇ ਹੋ ਕੇ ਇਸ ਚੀਜ਼ ਦਾ ਬਦਲਾ ਜ਼ਰੂਰ ਲਵਾਂਗਾ ਇਹਨਾਂ ਲੋਕਾਂ ਦੀ ਚੀਕਾਂ ਜੋ ਕੂਏ 'ਚ ਗਿਰ ਗਏ ਸੀ ਕਿੰਨੇ ਬੱਚੇ ਆਪਣੀ ਜਾਨ ਬਚਾਉਣ ਲਈ ਮਰ ਗਏ ਸੀ ਅੱਜ ਵੀ ਉਹਨਾਂ ਦੇ ਦੀਵਾਰਾਂ 'ਤੇ ਉਹ ਗੋਲੀਆਂ ਦੇ ਨਿਸ਼ਾਨ ਆ ਉਹਨਾਂ ਦਾ ਬਦਲਾ ਲੈਣ ਲਈ ਉਹਨਾਂ ਨੇ ਬੰਬ ਸੁੱਟਿਆ ਸੀਗਾ ਪਰ ਉਹਨਾਂ ਨੇ ਬੰਬ ਲੋਕਾਂ ਨੂੰ ਮਾਰਨ ਲਈ ਕਦੀ ਨਹੀਂ ਸੁੱਟਿਆ ਸੀ ਭਾਵੇਂ ਅੰਗਰੇਜ਼ ਜਿੱਦਾਂ ਦੇ ਸੀ ਕਿ ਜਿਨ੍ਹਾਂ ਨੇ ਸਾਡੇ ਲੋਕਾਂ ਨੂੰ ਮਾਰਤਾ ਪਰ ਸਾਡੇ ਜੋ ਲੋਕ ਸੀ ਉਹ ਕਦੇ ਵੀ ਉਹਨਾਂ ਦੇ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦੇ ਸੀ ਕਦੇ ਵੀ ਅੰਗਰੇਜ਼ ਦੇ ਬੀਵੀ ਬੱਚਿਆਂ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਉਹਨਾਂ ਨੇ ਬੰਬ ਸੁੱਟ ਕੇ ਇਹ ਦਿਖਾਇਆ ਕਿ ਅਸੀਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੇ ਪਰ ਅਸੀਂ ਤੁਹਾਡੇ ਤੋਂ ਡਰਦੇ ਵੀ ਨਹੀਂ ਹੈਗੇ ਤੁਸੀਂ ਸਾਡੇ 'ਤੇ ਕਦੀ ਕਾਬੂ ਨਹੀਂ ਕਰ ਸਕਦੇ ਅਸੀਂ ਆਪਣਾ ਇਹ ਦੇਸ਼ ਇੱਕ ਦਿਨ ਪੱਕਾ ਆਜ਼ਾਦ ਕਰਾ ਲਾਂਗੇ ਤਾਂ ਉਹ ਮੇਰੇ ਲਈ ਬਹੁਤ ਹੀ ਜ਼ਿਆਦਾ ਮਾਣ ਦਾ ਦਿਨ ਸੀ ਮਾਣ ਦੇ ਦਿਨ ਤਾਂ ਬਹੁਤ ਸਾਰੇ ਸੀ ਜਿੱਦਾਂ ਇੱਕ ਅਠਾਰਾਂ ਸੌ ਸੰਤਾਵਨ ਦੀ ਜੋ ਕ੍ਰਾਂਤੀ ਸੀਗੀ ਜੋ ਮੇਰਠ ਤੋਂ ਸ਼ੁਰੂ ਹੋਈ ਸੀ ਮੰਗਲ ਪਾਂਡੇ ਜੀ ਨੇ ਸ਼ੁਰੂ ਕੀਤੀ ਸੀਗੀ ਅਠਾਰਾਂ ਸੌ ਸੰਤਾਵਨ 'ਚ ਅੰਗਰੇਜ਼ਾਂ ਨੂੰ ਪਤਾ ਚੱਲ ਗਿਆ ਸੀ ਕਿ ਇੰਡੀਆ ਭਾਰਤ ਹੁਣ ਸਾਡੇ ਕਬਜ਼ੇ 'ਚ ਜ਼ਿਆਦਾ ਦੇਰ ਨਹੀਂ ਰਹਿਣ ਵਾਲਾ ਹੈ ਅਤੇ ਇੱਦਾਂ ਦੇ ਮਾਣ ਵਾਲੇ ਜੇ ਅਸੀਂ ਕਹੀਏ ਤਾਂ ਬਥੇਰੇ ਦਿਨ ਹੈਗੇ ਆ ਅਤੇ ਜੇ ਅਗਲਾ ਤੁਹਾਡਾ ਜੋ ਪ੍ਰਸ਼ਨ ਹੈ ਕਿ ਸੁਤੰਤਰਤਾ ਅੰਦੋਲਨ ਦੇ ਕੁਝ ਬੇਮਿਸਾਲ ਨੇਤਾਵਾਂ ਮੇਰਾ ਤਾਂ ਕਹਿਣਾ ਕਿ ਪੂਰਾ ਭਾਰਤ ਦੇਸ਼ 'ਚ ਜਿੰਨੇ ਵੀ ਵਿਅਕਤੀ ਜਿੰਨੀ ਵੀ ਪ੍ਰਜਾ ਸਾਰਾ ਹੀ ਬੇਮੇਮਸ ਬੇਮਿਸਾਲ ਸੀ ਲੇਕਿਨ ਜਿਨ੍ਹਾਂ ਨੇ ਇਹਨਾਂ ਨੂੰ ਆਪਣਾ ਪ੍ਰਸਾਹਣ ਦਿੱਤਾ ਸੀ ਆਪਣਾ ਲੀਡ ਕੀਤਾ ਸੀ ਉਹਨਾਂ 'ਚ ਮੈਂ ਜੇ ਨਾਮ ਲੈਣਾ ਚਾਹਾਂਗੀ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੇ ਅਹਿੰਸਾ ਦੇ ਪੁਜਾਰੀ ਸੀ ਅਤੇ ਉਹਨਾਂ ਨੇ ਅਹਿੰਸਾ ਦੇ ਰਾਹ 'ਤੇ ਭਾਰਤ ਨੂੰ ਆਜ਼ਾਦੀ ਦਿਲਾ ਤੀ ਦੂਜਾ ਭਗਤ ਸਿੰਘ ਜੀ ਉਹਨਾਂ ਦੇ ਬਾਰੇ ਤਾਂ ਮੈਂ ਹੁਣੇ ਦੱਸ ਹੀ ਚੁੱਕੀ ਹਾਂ ਸਰਦਾਰ ਪਟੇਲ ਜੀ ਮੰਗਲ ਪਾਂਡੇ ਜੀ ਜਵਾਹਰ ਲਾਲ ਨਹਿਰੂ ਜੀ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਬਹੁਤ ਸਾਰੇ ਧੰਨਵਾਦ ਜੀ